ਭੰਗੜੇ ਦੇ ਵਿੱਚ ਬਹੁਤ ਸਟੈਪ ਹੁੰਦੇ ਹਨ ਜਿਹਨਾਂ ਦੇ ਵਿੱਚ ਕੁਝ ਕੁ ਹਨ ਚਾਲ ਪੰਜਾਬ ਸ਼ੀਸ਼ਾ ਝੁਗਨੀ ਸਾਈਡ ਤਾਰੀ ਹਾਥੀ ਚਾਲ ਲੁੱਡੀ ਧਮਾਲ ਝੁੰਮਰ ਆਦਿ ਅਤੇ ਹੋਰ ਵੀ ਕਈ ਪਾਏ ਜਾਂਦੇ ਹਨ ਪਰ ਇਹਨਾਂ ਦੇ ਵਿੱਚ ਹਰ ਇੱਕ ਭੰਗੜੇ ਦਾ ਸਟੈਪ ਵੱਖਰਾ ਵੱਖਰਾ ਹੁੰਦਾ ਵਾ ਅਤੇ ਇਹ ਵੱਖਰੇ ਵੱਖਰੇ ਤਰੀਕੇ ਨਾਲ ਪਾਇਆ ਜਾਂਦਾ ਇਹਨਾਂ ਦੇ ਵਿੱਚ ਸਾਨੂੰ ਧਿਆਨ ਦੇਣ ਦੀ ਲੋੜ ਆ ਵੀ ਵੀ ਜ਼ੋਰ ਦਾ ਜ਼ੋਰਦਾਰ ਤਰੀਕੇ ਨਾਲ ਪਾਇਆ ਜਿਸ ਦੇ ਨਾਲ ਸਾਡਾ ਸਰੀਰ ਜੋਸ਼ੀਲਾ ਹੋਣਾ ਚਾਹੀਦਾ ਇਹਨਾਂ ਸਭ ਚੀਜ਼ 'ਤੇ ਸਭ ਤੋਂ ਪਹਿਲਾਂ ਜਿਹਨਾਂ ਦੇ ਨਾਲ ਕੀ ਸਾਨੂੰ ਵੀ ਇਹ ਬੰਦੇ ਨੂੰ ਪੂਰਾ ਸਾਹਮਣੇ ਵਾਲੇ ਬੰਦੇ ਨੂੰ ਫੀਲ ਹੋਵੇ ਵੀ ਹਾਂ ਇਹ ਅਸਲੀ ਭੰਗੜਾ ਇਹ ਅਸੀਂ ਕਰ ਰਹੇ ਹਾਂ ਜੋਸ਼ੀਲਾ ਭਰਿਆ ਪੂਰਾ ਹੋਣਾ ਚਾਹੀਦਾ ਕਿ ਵੇਖਣ ਵਾਲਾ ਇਨਸਾਨ ਖੜ੍ਹਾ ਹੋ ਜੇ ਹੱਕਾ ਡੱਕਾ ਰਹਿ ਜੇ ਉਹਨੂੰ ਸਮਝ ਨਾ ਆਵੇ ਵੀ ਇਹ ਕਰ ਕੀ ਰਿਹਾ ਕਿੰਨਾ ਸੁਰੀਲਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਜੋ ਉਹਦਾ ਜਸ਼ਨ ਸੁਭਾਅ ਵਿੱਚ ਯੋਗਦਾਨ ਕਿਵੇਂ ਬਣਦੇ ਆ ਇਹ ਯੋਗਦਾਨ ਪਾਂਦੇ ਆ ਵੀ ਜਿਹੜੇ ਜਿਹੜੇ ਭੰਗੜੇ ਦੇ ਸਟੈਪ ਹੁੰਦੇ ਆ ਉਹਨਾਂ ਵੱਲ ਅਸੀਂ ਧਿਆਨ ਦੇਣਾ ਹੁੰਦਾ ਵੀ ਕਿੱਦਾਂ ਕਿਹੜੇ ਤਰੀਕੇ ਨਾਲ ਹੋ ਰਿਹਾ ਜਿਹੜੇ ਸਟੈਪ ਹੁੰਦੇ ਭੰਗੜੇ ਦੇ ਉਹਨਾਂ ਦੇ ਨਾਲ ਹੀ ਇੱਕ ਸ਼ਾਨਦਾਰ ਸਹੀ ਤਰੀਕੇ ਦਾ ਜਿਹੜਾ ਭੰਗੜਾ ਉਹ ਕੀਤਾ ਜਾ ਸਕਦਾ ਉਹਨਾਂ ਵੱਲ ਹੀ ਧਿਆਨ ਦੇਣਾ ਚਾਹੀਦਾ ਜੇ ਭੰਗੜੇ ਦੇ ਸਟੈਪ ਹੀ ਗਲਤ ਹੋਣਗੇ ਤਾਂ ਉਹ ਭੰਗੜਾ ਭੰਗੜਾ ਹੀ ਨਹੀਂ ਰਹੇਗਾ ਉਹਦੀ ਜ਼ੋਰਦਾਰ ਕੁਝ ਮਜ਼ਾ ਹੀ ਨਹੀਂ ਆਵੇਗਾ ਉਸਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਬਸ ਉਹੀ ਚੀਜ਼ ਆ ਪੂਰਾ ਸਟੇਜ ਜਿਹੜਾ ਹੈਗਾ ਉਹ ਕੰਬ ਜਾਵੇ ਇੱਦਾਂ ਦਾ ਭੰਗੜਾ ਹੋਣਾ ਚਾਹੀਦਾ ਜੋ ਤਾਰ ਪੰਜਾਬ ਦੇ ਵਿੱਚ ਭੰਗੜਾ ਲੋਕ ਸਿੱਧਾ ਪੰਜਾਬੀ ਮੁੰਡੇ ਕੁੜੀਆਂ ਬਹੁਤ ਸੋਹਣਾ ਭੰਗੜਾ ਪਾਉਂਦੀਆਂ ਵਾ ਅਤੇ ਇੱਦਾਂ ਜਦੋਂ ਇਹ ਭੰਗੜਾ ਪਾਉਂਦੀਆਂ ਨਾ ਇੱਦਾਂ ਲੱਗਦਾ ਵੀ ਬਸ ਉਹਨਾਂ ਨੂੰ ਵੇਖਦੇ ਰਹੀਏ ਹੋਰ ਕੁਝ ਨਾ ਕਰੀਏ ਉਹਨਾਂ ਨੂੰ ਸਿਰਫ ਵੇਖਣਾ ਹੀ ਵੇਖਣਾ ਆਨੰਦ ਇੰਨਾਂ ਆਨੰਦ ਸਕੂਨ ਆਉਂਦਾ ਵੇਖ ਕੇ ਕਿ ਉਹਨਾਂ ਦਾ ਸਰੀਰ ਤਾਂ ਜੋਸ਼ੀਲਾ ਹੁੰਦਾ ਹੀ ਹੁੰਦਾ ਉਹਨਾਂ ਦੇ ਨਾਲ ਸਾਡਾ ਸਰੀਰ ਵੀ ਬਹੁਤ ਜੋਸ਼ੀਲਾ ਹੋ ਜਾਂਦਾ